ਮੀਡੀਆ ਸਾਡੀ ਆਮ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਅਤੇ ਕਿਸੇ ਵੀ ਰਾਜ ਦੇ ਵਿਕਾਸ ਵਿੱਚ ਅ ਮੀਡੀਆ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਮੈਨੂੰ ਯਾਦ ਹੈ ਜਦੋਂ ਸਰਕਾਰ ਨੇ ਕਿਸਾਨ ਬਿੱਲ ਪਾਸ ਕੀਤਾ ਸੀ ਅਤੇ ਕਿਸਾਨਾਂ ਨੂੰ ਇਹ ਬਿੱਲ ਬਿਲਕੁਲ ਪਸੰਦ ਨਹੀਂ ਸੀ ਬਿਕੋਜ਼ ਇਹ ਨਾ ਇਹ ਬਿੱਲ ਉਹਨਾਂ ਦੇ ਵਿਕਾਸ ਤੋਂ ਵਿਰੁੱਧ ਸੀ ਉਦੋਂ ਕਿਸਾਨ ਧਰਨੇ ਉੱਤੇ ਬੈਠ ਗਏ ਸੀ ਅਤੇ ਮੀਡੀਆ ਨੇ ਕਿਸਾਨਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਵਿੱਚ ਉਹਨਾਂ ਦੀ ਬਹੁਤ ਸਹਾਇਤਾ ਕੀਤੀ ਨਾ ਕੇਵਲ ਕਿਸਾਨਾਂ ਦੀ ਬਲਕਿ ਆਮ ਲੋਕਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ ਉਹ ਮੀਡੀਆ ਰਾਹੀਂ ਹੀ ਸਰਕਾਰ ਤੱਕ ਪਹੁੰਚਾਈ ਜਾਂਦੀ ਹੈ ਅਤੇ ਸਾਡੇ ਕਾਨੂੰਨ ਵਿੱਚ ਅਜੇ ਕਈ ਸੈਕਸ਼ਨ ਹਨ ਜਿਹੜੇ ਸਾਨੂੰ ਉਦਯੋਗਾਂ ਅਤੇ ਹੋਰ ਚੀਜ਼ਾਂ ਨੂੰ ਸਲਾਹ ਦੇਣ ਪ੍ਰਤੀ ਕੰਮ ਕਰਦੇ ਹਨ ਅਤੇ ਸਾਡਾ ਅਧਿਕਾਰ ਦਿਵਾਉਣ ਲਈ ਸਾਨੂੰ ਮਦਦ ਕਰਦੇ ਹਨ ਇਹੋ ਜਿਹੇ ਕਈ ਮੈਗਜ਼ੀਨ ਪ੍ਰੋਗਰਾਮ ਹਨ ਜਿਨ੍ਹਾਂ ਵਿੱਚ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ